ਦਸ ਜੁਲਾਈ ਉੱਨੀ ਸੌ ਪਚਾਨਵੇਂ ਉਣੱਤੀ ਨਵੰਬਰ ਅਠਾਰਾਂ ਸੌ ਛਿਆਨਵੇਂ ਤੀਹ ਮਾਰਚ ਉੱਨੀ ਸੌ ਅਠਾਨਵੇਂ ਪੱਚੀ ਅਗਸਤ ਉੱਨੀ ਸੌ ਸੰਤਾਲ਼ੀ ਪੰਦਰਾਂ ਜੂਨ ਉੱਨੀ ਸੌ ਅਠਾਸੀ